ਹਾਂਜੀ ਮੈਂ ਬੈਂਕ ਦੁਆਰਾ ਜਾਰੀ ਕੀਤੇ ਹੋਏ ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਦੇ ਕਾਫ਼ੀ ਹੈਲਪ ਲੈਨਾ ਕਿਉਂਕਿ ਇਹਦੇ ਨਾਲ ਮੇਰਾ ਇੱਕ ਤਾਂ ਫ਼ਾਇਦਾ ਇਹ ਰਹਿੰਦਾ ਹੈ ਕਿ ਮੈਨੂੰ ਆਪਣੀ ਜੇਬ ਦੇ ਵਿੱਚ ਕੋਈ ਐਕਸੈਸ ਮਾਤਰਾ ਦੇ ਵਿੱਚ ਕਹੀਏ ਤਾਂ ਪੈਸੇ ਰੱਖਣ ਦੀ ਲੋੜ ਨਹੀਂ ਪੈਂਦੀ ਜਿੰਦਾ ਅੱਜ ਕੱਲ੍ਹ ਬਹੁਤ ਡਰ ਰਹਿੰਦਾ ਕਿਉਂਕਿ ਡੈਬਿਟ ਕਾਰਡ ਔਰ ਕ੍ਰੈਡਿਟ ਕਾਰਡ ਇੱਕ ਐਸੀ ਆਪਸ਼ਨਸ ਨੇ ਬੈਂਕਾਂ ਵੱਲੋਂ ਪ੍ਰੋਵਾਈਡ ਕੀਤੀਆਂ ਗਈਆਂ ਜਿੱਥੇ ਵੀ ਅਸੀਂ ਜਾਂਦੇ ਹਾਂ ਸ਼ੋਪਿੰਗ ਕਰ ਲਈਏ ਜਾਂ ਆਪਾਂ ਮਾਰਕੀਟ ਦੇ ਵਿੱਚ ਕੋਈ ਵੀ ਚੀਜ਼ ਖਰੀਦ ਦੇ ਹਾਂ ਇਲੈਕਟਰੀਸਿਟੀ ਅਗਰ ਬਿੱਲ ਪੇ ਕਰਨਾ ਹੋਵੇ ਅਗਰ ਕਿਸੇ ਨੂੰ ਪੇਮੈਂਟ ਦੇਣੀ ਹੋਵੇ ਤਾਂ ਅਸੀਂ ਬੈਂਕ ਦੇ ਖੁੱਲ੍ਹਣ ਦੀ ਨਹੀਂ ਕਰ ਸਕਦੇ ਤਾਂ ਉਸ ਜਗ੍ਹਾ 'ਤੇ ਸਾਨੂੰ ਡੈਬਿਟ ਕਾਰਡ ਔਰ ਕ੍ਰੈਡਿਟ ਕਾਰਡ ਬਹੁਤ ਹੀ ਫ਼ਾਇਦੇਮੰਦ ਰਹਿੰਦੇ ਹਨ ਔਰ ਮੈਂ ਤਕਰੀਬਨ ਜ਼ਿਆਦਾਤਰ ਇਨਾਂ ਕਾਰਡ ਦਾ ਕਾਫ਼ੀ ਪ੍ਰਯੋਗ ਕਰਦਾ ਰਹਿੰਦਾ ਔਰ ਇਹ ਚੀਜ਼ ਦਾ ਕੈਸ਼ਲੈਸ ਪੇਮੈਂਟ ਦੇ ਵਿੱਚ ਕਾਫ਼ੀ ਫ਼ਾਇਦੇਮੰਦ ਨੇ ਔਰ ਹਰ ਇਨਸਾਨ ਨੂੰ ਇਨ੍ਹਾਂ ਦਾ ਪ੍ਰਯੋਗ ਕਰਦੇ ਵੀ ਰਹਿਣਾ ਚਾਹੀਦਾ ਹੈ